ਜ਼ਿਆਦਾਤਰ ਪਿੰਡਾਂ ਵਿੱਚ ਇਹ ਟੂਰਨਾਮੈਂਟ ਕਰਾਏ ਜਾਂਦੇ ਹਨ ਪਿੰਡਾਂ ਦੇ ਜਿਹੜੇ ਸਿਆਸੀ ਸਮੂਹ ਜਾਂ ਸੰਗਠਨ ਹੁੰਦੇ ਹਨ ਉਹ ਇਹ ਮਿਲ ਕੇ ਟੂਰਨਾਮੈਂਟ ਕਰਦੇ ਹਨ ਇਸ ਵਿੱਚ ਕਈ ਪ੍ਰਕਾਰ ਦੀਆਂ ਖੇਡਾਂ ਖਿਡਾਈਆਂ ਜਾਂਦੀਆਂ ਹਨ ਜਿਵੇਂ ਕਿ ਫੁੱਟਬਾਲ ਵੋਲੀਬਾਲ ਕ੍ਰਿਕਟ ਵਗੈਰਾ ਖੇਡਾਂ ਖਿਡਾਈਆਂ ਜਾਂਦੀਆਂ ਹਨ ਪਿੰਡਾਂ ਦੇ ਲੋਕ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਜਿਸ ਵਿੱਚ ਇਸ ਇਹਨਾਂ ਖੇਡਾਂ ਵਿੱਚ ਜਿੱਦਣ ਦੇ ਪਿੰਡਾਂ ਦੇ ਲੋਕ ਲੋਕਾਂ ਨੂੰ ਇਨਾਮ ਟਰੋਫੀਆਂ ਜਾਂ ਕੁਝ ਪੈਸੇ ਇਨਾਮ ਦੇ ਤੌਰ 'ਤੇ ਦਿੱਤੇ ਜਾਂਦੇ ਹਨ ਉਹ ਪਿੰਡਾਂ ਜਿਹੜੇ ਸਿਆਸੀ ਸਮੂਹ ਜਾਂ ਸੰਗਠਨ ਹੁੰਦੇ ਹਨ ਖੇਡਾਂ ਖਿਡਾਉਣ ਵਾਲੇ ਉਹ ਕਈ ਦਿਨ ਪਹਿਲਾਂ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਉਹ ਜਿਵੇਂ ਕਿ ਜਿਸ ਥਾਂ 'ਤੇ ਉਹਨਾਂ ਨੇ ਟੂਰਨਾਮੈਂਟ ਕਰਨਾ ਹੈ ਜਿਹੜੀਆਂ ਟੂਰਨਾਮੈਂਟ ਵਿੱਚ ਜਿੱਤਣ 'ਤੇ ਟਰੋਫੀ ਦਿੱਤੀ ਜਾਣਗੀਆਂ ਉਹ ਖਰੀਦ ਲੈਂਦੇ ਹਨ ਇਸੇ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਹੁੰਦੀਆਂ ਹਨ ਉਹ ਕਾਫੀ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਪਿੰਡਾਂ ਵਿੱਚ ਇਹ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਟੂ ਟੂਰਨਾਮੈਂਟ ਕਰਵਾਏ ਜਾਣਗੇ ਖੇ ਖੇਡ ਟੂਰਨਾਮੈਂਟ ਹੋਣਗੇ ਅਤੇ ਉਸ ਵਿੱਚ ਲੋਕਾਂ ਨੇ ਹਿੱਸਾ ਲੈਣਾ ਹੈ ਅਤੇ ਉਹਨਾਂ ਨੂੰ ਜਿੱਤਣ 'ਤੇ ਕੁਝ ਪੈਸੇ ਇਨਾਮ ਦੇ ਤੌਰ 'ਤੇ ਜਾਂ ਟਰੋਫੀਆਂ ਮਿਲਣਗੀਆਂ ਤਾਂ ਲੋਕ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਲੈਂਦੇ ਹਨ